ਤੈਰਾਕੀ ਕਰਨ ਦੇ ਸਾਨੂੰ ਜੀ ਸਿਹਤ ਦੇ ਬਹੁਤ ਸਾਰੇ ਫ਼ਾਇਦੇਮੰਦ ਹੈ ਜਿਵੇਂ ਕਿ ਸਾਡੇ ਸਰੀਰ ਦੇ ਫੇਫੜੇ ਤੰਦਰੁਸਤ ਰਹਿੰਦੇ ਹਨ ਸਾਹ ਲੈਣ ਕੋਈ ਸਾਨੂੰ ਦਿੱਕਤ ਨਹੀਂ ਆਉਂਦੀ ਹੋਰ ਸਾਡੇ ਹੱਥ ਪੈਰ ਵੀ ਸਹੀ ਚੱਲਦੇ ਨੇ ਸਾਡਾ ਸਰੀਰ ਬਹੁਤ ਵਧੀਆ ਕੰਮ ਕਰਦਾ ਹੈ ਅਤੇ ਵਧੀਆ ਅਸੀਂ ਲੰਬੀ ਉਮਰ ਵੀ ਭੋਗਦੇ ਹਾਂ ਤੈਰਾਕੀ ਕਰਨ ਕਰਕੇ ਸਾਨੂੰ ਸਾਹ 'ਚ ਕਦੇ ਵੀ ਕੋਈ ਦਿੱਕਤ ਨਹੀਂ ਆਉਂਦੀ ਸਾਡਾ ਸਰੀਰ ਬਹੁਤ ਸਹੀ ਰਹਿੰਦਾ ਹੈ